ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਲਿੰਗ ਅਸਮਾਨਤਾ ਅਤੇ ਵਿਤਕਰੇ ਦੇ ਮੁੱਦੇ ਨੂੰ ਹੱਲ ਕਰਨ ਦੇ ਵਾਸਤੇ ਬਹੁਤ ਸਾਰੀਆਂ ਪੋਲਸਿਸ ਜਿਹੜੀਆਂ ਨੇ ਨੀਤੀਆਂ ਬਣਾਉਣ ਦੀ ਲੋੜ ਹੈ ਇਹ ਨੀਤੀਆਂ ਸਭ ਤੋਂ ਪਹਿਲਾਂ ਜਦੋਂ ਬਣਾਈਆਂ ਜਾਣ ਤਾਂ ਇਹਦੇ ਵਿੱਚ ਹੀ ਪਹਿਲਾਂ ਜਿਹੜੀ ਆ ਔਰਤਾਂ ਅਤੇ ਮਰਦਾਂ ਦੀ ਜਿਹੜੀ ਰੇਸ਼ੋ ਹੈ ਜਿਹੜਾ ਅਨੁਪਾਤ ਉਹਨੂੰ ਬਰਾਬਰ ਰੱਖਿਆ ਜਾਵੇ ਜਦੋਂ ਇਹ ਨੀਤੀਆਂ ਬਣਾਉਣੀਆਂ ਨੇ ਤਾਂ ਇਹਨਾਂ ਨੀਤੀਆਂ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਕਿ ਜਦੋਂ ਇਹ ਨੀਤੀਆਂ ਬਨਣ ਤਾਂ ਔਰਤਾਂ ਆਪਣੇ ਹੱਕਾਂ ਦੇ ਵਾਸਤੇ ਪਹਿਲਾਂ ਹੀ ਸਾਰੀ ਗੱਲ ਜਿਹੜੀ ਆ ਉਹ ਕਰ ਲੈਣ ਅਤੇ ਜਿਹੜੀ ਵੁਮਨ ਜਿਹੜੀ ਇਮ ਇਮਪਾਵਰਮੈਂਟ ਸਕੀਮ ਆ ਹੈ ਨਾ ਜਿਹੜੀ ਕਿ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਅਸਮਾਨ ਅਧਿਕਾਰ ਦੇਣ ਦੀ ਜਿਹੜੀ ਸਕੀਮ ਹੈ ਉਹ ਵੀ ਲਾਗੂ ਕੀਤੀ ਜਾਣੀ ਚਾਹੀਦੀ